ਪੰਜਾਬੀ ਭਾਸ਼ਾ ਜਿਹੜੀ ਆ ਉਹ ਪੰਜਾਬ ਦੇ ਸੱਭਿਆਚਾਰ ਦੇ ਉੱਤੇ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਆ ਜਿਹੜੀ ਇਹ ਭਾਸ਼ਾ ਵਾ ਇਹ ਗੁਰੂ ਸਾਹਿਬਾਨ ਦੇ ਵੇਲੇ ਦੀ ਤੁਰੀ ਆਉਂਦੀ ਆ ਗੁਰੂ ਸਾਹਿਬ ਜੀ ਨੇ ਸਾਨੂੰ ਇਹਦੇ ਪੈਂਤੀ ਅੱਖਰ ਦਿੱਤੇ ਸੀਗੇ ਉਹਨਾਂ ਅੱਖਰਾਂ ਦੇ ਨਾਲ਼ ਕਈ ਜਿਹੜੇ ਸਾਹਿਤਕਾਰ ਆ ਉਹਨਾਂ ਨੇ ਬਹੁਤ ਵਧੀਆ ਇਹਨਾਂ ਦਾ ਲਿਖਿਆ ਵਾ ਜਿੱਦਾਂ ਪੁਰਾਤਨ ਸਮੇਂ 'ਚ ਵਾਰਿਸ ਸ਼ਾਹ ਦੀ ਹੀਰ ਆ ਨਾਨਕ ਸਿੰਘ ਨਾਵਲਕਾਰ ਬਹੁਤ ਮਸ਼ਹੂਰ ਹੋਏ ਨੇ ਗੁਰਮੁੱਖ ਸਿੰਘ ਦੀਆਂ ਜਿਹੜੀਆਂ ਪ੍ਰੀਤਲੜੀ ਆ ਉਹਨਾਂ ਦੀਆਂ ਕਹਾਣੀਆਂ ਸ਼ਿਵ ਕੁਮਾਰ ਬਟਾਲਵੀ ਉਹਨਾਂ ਦੇ ਜਿਹੜੀਆਂ ਬਿਰਹਾ ਦੇ ਕਵੀ ਕਿਹਾ ਗਿਆ ਉਹਨਾਂ ਨੂੰ ਉਹਨਾਂ ਦੇ ਗੀਤ ਸੰਗੀਤ ਗਾਣੇ ਜਿਹੜੇ ਅੱਜ ਕੱਲ੍ਹ ਪੂਰੇ ਜਿਹੜੇ ਵਰਲਡ ਫੇਮਸ ਹੋਏ ਆ ਜਿਹਨਾਂ ਦੇ ਵਿੱਚ ਹਾਲੀਵੁੱਡ ਬੋਲੀਵੁੱਡ ਤੱਕ ਜਿਹੜੇ ਪੰਜਾਬੀ ਸਿੰਗਰ ਪਹੁੰਚੇ ਜਿਵੇਂ ਦਲਜੀਤ ਦੋਸਾਂਝ ਸਿੱਧੂ ਮੂਸੇਵਾਲਾ ਮਨਮੋਹਨ ਵਾਰਸ ਗੁਰਦਾਸ ਮਾਨ ਹੁਣੀ ਇਹਨਾਂ ਨੇ ਬਹੁਤ ਜਿਹੜੀ ਤਰੱਕੀ ਬਖਸ਼ੀ ਹੈ ਕੀਤੀ ਆ ਇਹਦੇ ਵਿੱਚ ਪੰਜਾਬੀ ਸੱਭ ਬੋਲੀ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਆ ਇਹਦੇ ਇਸ ਟਾਈਮ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਦੇਸ਼ਾਂ ਦੇ ਵਿੱਚ ਬੋਲੀ ਜਾਣ ਵਾਲੀ ਬੋਲੀ ਆ ਪੰਜਾਬ ਨੂੰ ਛੱਡ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਕਈਆਂ ਦੇਸ਼ਾਂ 'ਚ ਦੂਸਰੀ ਭਾਸ਼ਾ ਕਈਆਂ ਦੇਸ਼ਾਂ ਦੇ ਵਿੱਚ ਤੀਸਰੀ ਭਾਸ਼ਾ ਜਿਹੜੀ ਆ ਉਹ ਹੈਗੀ ਆ ਹੁਣ ਮਾਨਤਾ ਪ੍ਰਾਪਤ ਆ ਇਹਨੂੰ